ਨਹੀਂ ਮੈਂ ਫੋਟੋਗਰਾਫੀ ਦੀ ਕੋਈ ਰਸਮੀ ਸਿਖਲਾਈ ਜਾਂ ਕੋਈ ਪ੍ਰੋਫੈਸ਼ਨਲ ਕੋਰਸ ਤਾਂ ਨਹੀਂ ਕੀਤਾ ਮੈਂ ਆਪਣੇ ਕਾਲਜ ਟਾਈਮ ਹੀ ਪਾਰਟ ਟਾਈਮ ਇੱਕ ਵੈਡਿੰਗ ਫੋਟੋਗ੍ਰਾਫਰ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਅਤੇ ਜਿਵੇਂ ਕਹਿੰਦੀ ਆ ਕਹਿੰਦੇ ਆ ਵੀ ਪ੍ਰੈਕਟਿਸ ਇਨਸਾਨ ਨੂੰ ਪਰਫੈਕਟ ਬਣਾਉਂਦੀ ਆ ਹੈ ਨਾ ਤਾਂ ਇਸ ਤਰ੍ਹਾਂ ਜਿਵੇਂ ਜਿਵੇਂ ਮੈਂ ਉਹਨਾਂ ਨਾਲ ਕੰਮ ਕਰਦਾ ਰਿਹਾ ਤਾਂ ਮੇਰੇ ਹੁਨਰ 'ਚ ਵੀ ਨਿਖਾਰ ਆਈ ਗਿਆ ਹੈ ਨਾ ਅਤੇ ਉਨ ਕੰਮ ਕਰਦੇ ਕਰਦੇ ਮੈਨੂੰ ਫੋਟੋਗ੍ਰਾਫੀ ਦੀਆਂ ਤਕਨੀਕਾਂ ਦਾ ਤਕਨੀਕੀ ਗਿਆਨ ਆ ਜਿਹੜਾ ਉਹ ਮਿਲਿਆ ਹੈ ਨਾ ਜਿਵੇਂ ਮੈਨੂੰ ਕਾਫੀ ਲੋਕੇਸ਼ਨਾ ਲੋਕੇਸ਼ਨਾਂ ਦੀ ਚੋਣ ਆ ਹੈ ਨਾ ਅਤੇ ਬੈਕਗਰਾਊਂਡ ਕਿੱਦਾਂ ਦਾ ਹੋਣਾ ਚਾਹੀਦਾ ਕਿੱਦਾਂ ਰੋਸ਼ਨੀ ਅਤੇ ਕਿੱਦਾਂ ਦੇ ਪੋਜ ਦੇ ਵਿੱਚ ਹੈ ਨਾ ਫੋਟੋਗਰਾਫੀ ਕਰਨੀ ਹੈ ਨਾ ਉਹ ਸਾਰਾ ਕੁਝ ਸਿੱਖਣ ਨੂੰ ਮਿਲਿਆ ਹੈ ਨਾ ਅਤੇ ਜਿਵੇਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਜਿਹੜਾ ਪ੍ਰੀ ਵੈਡਿੰਗਾਂ ਦਾ ਕਾਫੀ ਪ੍ਰਚਲਣ ਚੱਲ ਰਿਹਾ ਤਾਂ ਇਹਦੇ ਵਿੱਚ ਅਸੀਂ ਜਦੋਂ ਵੱਖ ਵੱਖ ਲੋਕੇਸ਼ਨਾਂ 'ਤੇ ਜਾ ਕੇ ਫੋਟੋਸ਼ੂਟ ਕਰਦੇ ਹਾਂ ਤਾਂ ਉੱਤੇ ਸਾਨੂੰ ਇਸ ਫੋਟੋਗ੍ਰਾਫੀ ਦੇ ਨਾਲ ਪੋਰਟਰੇਟ ਫੋਟੋਗ੍ਰਾਫੀ ਜੇ ਸਾਡੇ ਹੁਨਰ 'ਚ ਕਾਫੀ ਨਿਖਾਰ ਆਇਆ ਜਿਹੜਾ ਅਤੇ ਜਿਹੜਾ ਫੋਟੋਗ੍ਰਾਫੀ ਦੇ ਵਿੱਚ ਮੇਰਾ ਇੱਕ ਪ੍ਰੇਰਣਾ ਹੈਗਾ ਉਹ ਸਰਦਾਰ ਜੀ ਫੋਟੋਗ੍ਰਾਫੀ ਹੈ ਉਹ ਨਹੀਂ ਗੇ ਅਤੇ ਓ ਉਹਨਾਂ ਤੋਂ ਵੀ ਮੈਂ ਕਾਫੀ ਕੁਝ ਸਿੱਖਦਾ ਰਹਿੰਦਾ ਗਾ ਉਹ ਫੋ ਜਿਹੜੇ ਸਰਦਾਰ ਜੀ ਫੋਟੋਗ੍ਰਾਫੀ ਵਾਲੇ ਆ ਇਹ ਪ੍ਰੀਵੈਡਿੰਗ ਵੈਡਿੰਗ ਅਤੇ ਪੋਟਰੇਟ ਫੋਟੋਗ੍ਰਾਫੀ ਦੇ ਬਹੁਤ ਜ਼ਿਆਦਾ ਮਾਹਰ ਆ ਧੰਨਵਾਦ ਜੀ